ਸਾਡੇ ਜ਼ਿਲ੍ਹੇ ਦਾ ਨਾਂ ਸ਼ਹੀਦ ਭਗਤ ਸਿੰਘ ਨਗਰ ਹੈ ਇਸ ਦੇ ਨਾਮ ਇਹ ਭਗਤ ਸਿੰਘ ਜੀ ਦੇ ਨਾਮ ਦੇ ਬਣਿਆ ਹੋਇਆ ਉੱਥੇ ਇੱਕ ਇਹ ਉਹਨਾਂ ਦੇ ਪਿੰਡ ਖਟਕੜ ਕਲਾਂ ਵਿਖੇ ਹੈ ਜੋ ਕਿ ਚਰਨ ਕੰਵਲ ਗੁਰਦੁਆਰਾ ਵੀ ਉ ਉੱਥੇ ਪੈਂਦਾ ਹੈ ਅਤੇ ਉੱਥੇ ਬਹੁਤ ਵੱਡੀ ਇੱਕ ਪਾਰਕ ਹੈ ਜਿੱਥੇ ਲੋਕ ਸੈਰ ਕਰਦੇ ਹਨ ਜਿੱਥੇ ਕਿ ਬਹੁਤ ਸੰਗੀਤਮਈ ਮਾਹੌਲ ਹੈ ਜਿੱਥੇ ਸਾਲ ਬਾਅਦ ਇੱਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿੱਥੇ ਸਾਰੇ ਬਹੁਤ ਅੱਛੇ ਕਲਾਕਾਰ ਆਉਂਦੇ ਹਨ ਜੋ ਕਿ ਬਹੁਤ ਹੀ ਵਧੀਆ ਹੁੰਦਾ ਹੈ ਪ੍ਰੋਗਰਾਮ ਇਹ ਇਸ ਕਰਕੇ ਇੱਥੇ ਹਰ ਤਰ੍ਹਾਂ ਦੀ ਸਹੂਲਤ ਹੁੰਦੀ ਹੈ ਲੋਕਾਂ ਨੂੰ ਇਹ ਪਿੰਡ ਵੀ ਸ਼ਹਿਰ ਵਰਗਾ ਹੈ ਖਟਕੜ ਕਲਾਂ ਜੋ ਕਿ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਬਣਿਆ ਹੋਇਆ ਹੈ ਭਗਤ ਸਿੰਘ ਜੀ ਉੱਥੇ ਕਾਫੀ ਟਾਈਮ ਰਹੇ ਔਰ ਬਾਅਦ ਵਿੱਚ ਉਹਨਾਂ ਨੇ ਕਾਫੀ ਸਾਰੀਆਂ ਆਜ਼ਾਦੀ ਦੀਆਂ ਲੜਾਈਆਂ ਲੜੀਆਂ ਜਿਨ੍ਹਾਂ ਕਰਕੇ ਉਹਨਾਂ ਦਾ ਨਾਮ ਉਹਨਾਂ ਦੇ ਨਾਮ 'ਤੇ ਹੀ ਸ਼ਹੀਦ ਭਗਤ ਸਿੰਘ ਨਗਰ ਬਣਿਆ ਹੋਇਆ ਹੈ ਇਹ ਇੱਕ ਮਹਾਨ ਫਰੀਡਮ ਫਾਈਟਰ ਵੀ ਰਹਿ ਚੁੱਕੇ ਹਨ ਸੋ ਇਹਨਾਂ ਦਾ ਬਹੁਤ ਹੀ ਮਹੱਤਵ ਹੈ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਜਿਨ੍ਹਾਂ ਦਾ ਬਹੁਤ ਹੀ ਖਾਸ ਤੌਰ 'ਤੇ ਭਗਤੀ ਵਿੱਚ ਤਾਂ ਨਹੀਂ ਸਨ ਕਹਿ ਸਕਦੇ ਅਸੀਂ ਪਰ ਉਹਨਾਂ ਨੇ ਬਹੁਤ ਹੀ ਲੜਾਈਆਂ ਲੜੀਆਂ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੋ ਅਸ਼ ਇਸ ਜ਼ਿਲ੍ਹੇ ਵਿੱਚ ਬਹੁਤ ਹੀ ਇਤਿਹਾਸਕ ਗੁਰਦੁਆਰੇ ਵੀ ਹਨ ਜੋ ਕਿ ਇਹਨਾਂ ਨਾਲ ਹੀ ਸੰਬੰਧਿਤ ਹਨ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਵਿੱਚ ਕਾਫੀ ਸਾਰੇ ਗੁਰਦੁਆਰੇ ਆਉਂਦੇ ਹਨ ਔਰ ਮੰਦਰ ਵੀ ਆਉਂਦੇ ਹਨ ਜੋ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਨਾਮ 'ਤੇ ਹੀ ਸ ਬਣੇ ਹੋਏ ਹਨ